ਮੇਰੇ ਕੋਲ ਇੱਕ ਖਾਸ ਜੁੱਤੇ ਜੋ ਕਿ ਇੱਕ ਖਾਸ ਕੰਪਨੀ ਵੱਲੋਂ ਬਣਾਏ ਹੋਏ ਹਨ ਉਹ ਹਨ ਜਿਨ੍ਹਾਂ ਨੂੰ ਪਾ ਕੇ ਅਤੇ ਪਹਿਨ ਕੇ ਉਹ ਮੈਂ ਖੇਡਣ ਦੇ ਦੌਰਾਨ ਦੌੜਨ ਦੇ ਦੌਰਾਨ ਆਪਣੇ ਆਪ ਨੂੰ ਬਹੁਤ ਹੀ ਅਰਾਮਦਾਇਕ ਅਤੇ ਬਹੁਤ ਹੀ ਸੌਖਾ ਅਤੇ ਸੁਖਾਲਾ ਮਹਿਸੂਸ ਕਰਦਾ ਹਾਂ ਉਹ ਜੁੱਤੇ ਮੈਂ ਬਹੁਤ ਸਮਾਂ ਪਹਿਲਾਂ ਖਰੀਦੇ ਸਨ ਜੋ ਕਿ ਬਹੁਤ ਕਿਫਾਇਤੀ ਅਤੇ ਬਹੁਤ ਹੀ ਸਹੀ ਕੰਡੀਸ਼ਨ ਦੇ ਵਿੱਚ ਅਜੇ ਵੀ ਮੌਜੂਦ ਹਨ ਮੇਰੇ ਕੋਲ ਅਤੇ ਇਹਨਾਂ ਜੁੱਤਿਆਂ ਦੇ ਨਾਲ ਜਿਹੜਾ ਚੱਲਣਾ ਬਹੁਤ ਆਸਾਨ ਹੈ ਬੜਾ ਅਰਾਮਦਾਇਕ ਮਹਿਸੂਸ ਹੁੰਦਾ ਹੈ ਅਤੇ ਮੇਰੇ ਇਸ ਦੇ ਨਾਲ ਨਾਲ ਜਿਹੜੇ ਖੇਡਣ ਵਾਸਤੇ ਜਿਹੜੇ ਕੱਪੜੇ ਪਹਿਨਣਾ ਪਸੰਦ ਕਰਦਾ ਹਾਂ ਉਹ ਟੀ ਸ਼ਰਟ ਅਤੇ ਲੋਅਰ ਹੈ ਜਿਸ ਨਾਲ ਕਿ ਆਰਾਮ ਨੂੰ ਖੇਡਣ ਦੇ ਦੌਰਾਨ ਆਰਾਮ ਵੀ ਰਹਿੰਦਾ ਹੈ ਅਤੇ ਪਸੀਨਾ ਜਾਂ ਗਰਮੀ ਘੱਟ ਮਹਿਸੂਸ ਹੁੰਦੀ ਹੈ ਖੇਡ ਦੇ ਦੌਰਾਨ ਸਟਰੈਚ ਕਰਦੇ ਵਕਤ ਲੱਤਾਂ ਬਾਹਵਾਂ ਨੂੰ ਖੋਲ੍ਹਦੇ ਵਕਤ ਅਤੇ ਐਕਸਰਸਾਈਜ਼ਾਂ ਕਰਦੇ ਵਕਤ ਜਿਹੜਾ ਕਿ ਅਰਾਮਦਾਇਕ ਇਹਨਾਂ ਪਹਿਰਾ ਇਸ ਪਹਿਰਾਵੇ ਨਾਲ ਅਰਾਮਦਾਇਕ ਮਹਿਸੂਸ ਹੁੰਦਾ ਹੈ ਜੁੱਤੇ ਅਤੇ ਖੇਡ ਵਰਦੀ ਦੇ ਨਾਲ ਇੱਕ ਖਿਡਾਰੀ ਦੀ ਸ਼ਮਤਾ ਵੀ ਵੱਧਦੀ ਹੈ ਅਤੇ ਉਸਦੀ ਕੈਪੇਬਿਲਟੀ ਵੀ ਵੱਧ ਜਾਂਦੀ ਹੈ ਖੇਡਣ ਦੀ ਉਸਦੀ ਮਿਆਦ ਵੀ ਵੱਧ ਜਾਂਦੀ ਹੈ ਅਤੇ ਜੁੱਤੇ ਉਸਦੇ ਪੈਰ ਨੂੰ ਸੁਰੱਖਿਅਤ ਵੀ ਰੱਖਦੇ ਹਨ ਕਿਸੇ ਤਰ੍ਹਾਂ ਦੀ ਸੱਟ ਫੇਟ ਤੋਂ ਵੀ ਬਚਾ ਕੇ ਰੱਖਦੇ ਹਨ